ਟੈਕਨੋਲੋਜੀ ਨੇ ਟਰਾਂਸਪੋਰਟ ਨੂੰ ਅਸਾਨ ਬਣਾਉਣ ਲਈ ਬਹੁਤ ਸਾਰੀ ਮਦਦ ਕੀਤੀ ਆ ਜਿੱਦਾਂ ਕਿ ਅਸੀਂ ਬਹੁਤ ਅਸਾਨੀ ਨਾਲ ਘਰ ਬੈਠੇ ਔਨਲਾਈਨ ਟਿਕਟਾਂ ਬੁੱਕ ਕਰ ਸਕਦੇ ਹਾਂ ਅਸੀਂ ਚਾਹੇ ਉਹ ਟ੍ਰੇਨ ਦੀ ਟਿਕਟ ਬੁੱਕ ਕਰਵਾਉਣੀ ਹੋਏ ਚਾਹੇ ਬੱਸ ਦੀ ਟਿਕਟ ਬੁੱਕ ਕਰਵਾਉਣੀ ਹੋਈ ਕਿਸੇ ਯਾਤਰਾ ਦੀ ਜਾਂ ਫਿਰ ਕਿਸੇ ਦੂਰ ਪਾਰ ਜਾਣ ਲਈ ਟੀ ਟਰੇਨ ਦੀ ਟਿਕਟ ਜਾਂ ਬੱਸ ਦੀ ਟਿਕਟ ਬੁੱਕ ਕਰਵਾਉਣੀ ਹੋਈ ਜਾਂ ਫਿਰ ਜਹਾਜ਼ ਦੀ ਟਿਕਟ ਕਰਵਾਉਣੀ ਹੋਈ ਅਸੀਂ ਅਸਾਨੀ ਨਾਲ ਘਰ ਬੈਠੇ ਕਰਵਾ ਸਕਦੇ ਹਾਂ ਅਤੇ ਘਰ ਬੈਠੇ ਸਾਨੂੰ ਔਨਲਾਈਨ ਟਿਕਟ ਸ਼ੋਅ ਹੋ ਜਾਂਦੀ ਆ ਉਸ ਤੋਂ ਇਲਾਵਾ ਜੇ ਅਸੀਂ ਅਪ ਕਿਤੇ ਕਿਤੇ ਆਪਣਾ ਟੂਰ 'ਤੇ ਜਾਣਾ ਹੈਗਾ ਆ ਫੈ ਆਪਣੇ ਘਰ ਵਾਲਿਆਂ ਨਾਲ ਜਾਣਾ ਹੈਗਾ ਤਾਂ ਆਪਾਂ ਸਾਰਿਆਂ ਦਾ ਹੀ ਸਭ ਕੁਝ ਇੱਕ ਪਲੈਨ ਕਰ ਸਕਦੇ ਹਾਂ ਅਸੀਂ ਕਿਸੇ ਵੀ ਐਪ ਦੇ ਥਰੂ ਜਿੱਦਾਂ ਬੁੱਕ ਮਾਏ ਬੁੱਕ ਮਾਏ ਐਪ ਆ ਜਾਂ ਫਿਰ ਕਿਸੇ ਵੀ ਟਰੈਵਲ ਯਾਤਰਾ ਜਾਂ ਕਿਸੇ ਵੀ ਮਤਲਬ ਐਪ ਦੇ ਥਰੂ ਆਸਾਨੀ ਨਾਲ ਬੁੱਕ ਕਰ ਸਕਦੇ ਹੋਟਲ ਦੀ ਬੁਕਿੰਗ ਹੋ ਜਾਂਦੀ ਆ ਵਿੱਚ ਤੁਹਾਡਾ ਜਾਣ ਦਾ ਵੀ ਸਾਰਾ ਕੁਝ ਹੋ ਜਾਂਦਾ ਆ ਅਤੇ ਇਸ ਤੋਂ ਇਲਾਵਾ ਅਸੀਂ ਟੈਕਨੋਲੋਜੀ ਇੰਨੀ ਜ਼ਿਆਦਾ ਵੱਧ ਗਈ ਹੋਈ ਹੈ ਕਿ ਐਪ ਬਣ ਗਏ ਹੋਏ ਆ ਪ੍ਰੋਪਰ ਕਿ ਅਸੀਂ ਬੱਸ ਆਪਣੀ ਲੋਕੇਸ਼ਨ ਉਹਦੀ ਕਿੱਥੋਂ ਕਿੱਥੇ ਆ ਰਹੀ ਹੈ ਸਭ ਕੁਛ ਪਤਾ ਕਰ ਸਕਦੇ ਜਿੱਦਾਂ ਕਿ ਅਸੀਂ ਔਰਤਾਂ ਰੋਡਵੇਜ਼ ਬੱਸ ਦਾ ਵੀ ਪਤਾ ਕਰ ਸਕਦੇ ਸੀ ਜਾਣਾ ਹੁੰਦਾ ਅਤੇ ਸਾਨੂੰ ਜੇ ਅਸੀਂ ਪਤਾ ਕਰਨਾ ਹੋਏ ਕਿ ਰੋਡਵੇਜ਼ ਬੱਸ ਕਿੱਥੇ ਪੁੱਜੀ ਆ ਜਾਂ ਉਹਦਾ ਕੀ ਟਾਈਮ ਆ ਉਹਦਾ ਵੀ ਪ੍ਰੋਪਰ ਐਪ ਬਣਿਆ ਹੋਇਆ ਸੀ ਬੱਸ ਦਾ ਨੰਬਰ ਪਾ ਸਕਦੇ ਹਾਂ ਜਾਂ ਫਿਰ ਉੱਦਾਂ ਵੀ ਨੋਰਮਲੀ ਵੀ ਲੋਕੇਸ਼ਨ ਪਾ ਕੇ ਅਤੇ ਅਸੀਂ ਪਤਾ ਕਰ ਸਕਦੇ ਕਿ ਸਾਡੀ ਬੱਸ ਕਿੰਨੇ ਟਾਈਮ 'ਤੇ ਆਉਣ ਵਾਲੀ ਹੈ ਅਤੇ ਅਸੀਂ ਕਿੱਦਾ ਜਾਣਾ ਆ ਲੋਕਲ ਲਈ ਵੀ ਅਤੇ ਭਾਵੇਂ ਕਿਤੇ ਦੂਰ ਜਾਣਾ ਟੈਕਨੋਲੋਜੀ ਨੇ ਬਹੁਤ ਮਦਦ ਕੀਤੀ ਆ ਆਉਣ ਜਾਣ ਲਈ ਯਾਤਰਾ ਨੂੰ ਸਫਲ ਬਣਾਉਣ ਲਈ ਜਾਂ ਫਿਰ ਸਾਡਾ ਮਤਲਬ ਇੱਕ ਤਰੀਕੇ ਦਾ ਸਭ ਕੁਝ ਅਸਾਨ ਬਣਾਇਆ ਹੋਇਆ